ਹਾਂਜੀ ਮੇਰਾ ਇੱਕ ਦੋਸਤ ਹੈ ਜਿਸ ਕੋਲ ਬੀ ਏ ਦੀ ਡਿਗਰੀ ਵੀ ਹੈ ਅਤੇ ਐਮ ਏ ਦੀ ਡਿਗਰੀ ਵੀ ਹੈ ਉਸਨੇ ਬੀ ਏ ਵੀ ਕੀਤੀ ਹੋਈ ਹੈ ਅਤੇ ਐਮ ਏ ਵੀ ਕੀਤੀ ਹੋਈ ਹੈ ਅਤੇ ਮੈਨੂੰ ਲੱਗਦਾ ਕਿ ਉਸਨੇ ਬੀ ਏ ਅਤੇ ਐਮ ਏ ਕਰਕੇ ਬਹੁਤ ਵਧੀਆ ਕੀਤਾ ਹੈ ਕਿਉਂਕਿ ਬੀ ਏ ਕਰਕੇ ਅਸੀਂ ਕੋਈ ਵੀ ਜੋਬ ਲੈਣ ਲਈ ਜਿਹੜੇ ਆ ਉਹ ਯੋਗ ਹੋ ਜਾਂਦੇ ਹਾਂ ਜਿਵੇਂ ਕਿ ਬੀ ਏ ਤੋਂ ਬਾਅਦ ਅਸੀਂ ਕਿਸੇ ਵੀ ਡਿਪਾਰਟਮੈਂਟ ਵਿੱਚ ਜੋਬ ਲੈ ਸਕਦੇ ਹਾਂ ਜੇ ਅਸੀਂ ਬੀ ਸੀ ਏ ਵਗੈਰਾ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਸਿਰਫ ਅਸੀਂ ਜ਼ਿਆਦਾਤਰ ਜੋ ਹੈ ਕੰਪਿਊਟਰ ਡਿਪਾਰਟਮੈਂਟ ਹੈ ਜੋ ਉਸ ਸਾਈਡ ਵੱਲ ਜਾ ਸਕਦੇ ਹਾਂ ਪਰ ਜਦੋਂ ਅਸੀਂ ਬੀ ਏ ਕਰਦੇ ਹਾਂ ਅਸੀਂ ਪੁਲਿਸ ਦੀ ਜੋਬ ਕਲੈਰੀਕਲ ਜੋਬ ਜਾਂ ਸਟੈਨੋਗ੍ਰਾਫਰ ਜਾਂ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਸੀਨੀਅਰ ਅਸਿਸਟੈਂਟ ਇੱਦਾਂ ਦੀਆਂ ਜਿਹੜੀਆਂ ਜੋਬਾਂ ਅਪਲਾਈ ਕਰ ਸਕਦੇ ਹਾਂ ਜੇ ਅਸੀਂ ਗੱਲ ਕਰੀਏ ਮਾਸਟਰ ਦੀ ਤਾਂ ਮਾਸਟਰ ਦੀ ਡਿਗਰੀ ਤੋਂ ਬਾਅਦ ਇਹ ਹੁੰਦਾ ਕਿ ਜੇ ਤੁਸੀਂ ਨੈੱਟ ਕੁਆਲੀਫਾਈ ਕਰ ਜਾਂਦੇ ਹੋ ਤਾਂ ਤੁਸੀਂ ਕਿਸੇ ਵੀ ਕੋਲਜ ਵਿੱਚ ਜਾਂ ਸਕੂਲ ਵਿੱਚ ਤੁਸੀਂ ਜਿਹੜਾ ਐਜ ਆ ਲੈਕਚਰਰ ਜਾਂ ਐਜ ਆ ਪ੍ਰੋਫੈਸਰ ਤੁਸੀਂ ਟੀਚ ਕਰ ਸਕਦੇ ਹੋ ਤਾਂ ਇਸ ਲਈ ਮੈਨੂੰ ਲੱਗਦਾ ਹੈ ਕਿ ਮੇਰੇ ਦੋਸਤ ਨੇ ਬੀ ਏ ਜਾਂ ਐੱਮ ਏ ਕਰਕੇ ਬਹੁਤ ਵਧੀਆ ਕੀਤਾ ਹੈ ਉਹ ਸਿਰਫ ਬੀ ਏ ਐਮ ਏ ਹੀ ਨਹੀਂ ਤੁਸੀਂ ਨਾਲ ਨਾਲ ਆਪਣੀ ਯੂ ਪੀ ਐਸ ਸੀ ਦੀ ਤਿਆਰੀ ਕਰ ਸਕਦੇ ਹੋ ਆਪਣੇ ਸਟੇਟ ਐਗਜ਼ਾਮ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਜੋਬ ਹੈ ਜਿਹੜੀ ਉਹ ਕਰ ਸਕਦੇ ਹੋ ਤਾਂ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਸਿਰਫ ਬੀ ਏ ਤੱਕ ਹੀ ਨਹੀਂ ਰਹਿਣਾ ਚਾਹੀਦਾ ਤੁਹਾਨੂੰ ਅੱਗੇ ਮਾਸਟਰ ਡਿਗਰੀ ਜਿੱਦਾਂ ਹੈ ਜਾਂ ਬੀ ਐੱਡ ਹੈ ਉਹ ਵੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਉਹ ਡਿਗਰੀ ਕਰਕੇ ਤੁਹਾਨੂੰ ਸਿਰਫ ਉਹ ਡਿਗਰੀ ਹੀ ਨਹੀਂ ਹੁੰਦੀ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਿਹੜਾ ਹੈ ਅੱਗੇ ਆਪਣੀ ਜਿਹੜੀ ਸਿੱਖਿਆ ਹੈ ਜਾਂ ਜੋ ਆਪਣੀ ਸਟੱਡੀ ਹੈ ਉਹਨੂੰ ਅੱਗੇ ਕੰਟੀਨਿਊ ਰੱਖਣਾ ਚਾਹੀਦਾ